ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਮੈਨੂੰ ਬਚਪਨ ਤੋਂ ਹੀ ਬਹੁਤ ਹੀ ਜ਼ਿਆਦਾ ਘੁੰਮਣ ਫਿਰਨ ਦਾ ਸ਼ੌਂਕ ਹੈ ਅਤੇ ਮੈਂ ਘੁੰਮਣ ਫਿਰਨ ਦੀ ਬਹੁਤ ਹੀ ਜ਼ਿਆਦਾ ਆਦੀ ਸੀ ਮੈਨੂੰ ਕੋਈ ਵੀ ਫਰੀ ਟਾਈਮ ਮਿਲਦਾ ਤਾਂ ਮੈਂ ਘੁੰਮਣ ਫਿਰਨ ਨਿਕਲ ਜਾਂਦੀ ਸੀ ਪਰ ਇਸ ਵਾਰ ਇੱਕ ਵਾਰ ਇੱਕ ਮੇਰਾ ਇੱਦਾਂ ਹੀ ਘੁੰਮਣ ਦਾ ਬਹੁਤ ਮਨ ਸੀ ਉਸ ਵੇਲੇ ਮੇਰੇ ਤੋਂ ਪੈਸੇ ਇੰਨੇ ਜ਼ਿਆਦਾ ਨਹੀਂ ਸੀ ਮੇਰੇ ਤੋਂ ਉਹ ਬਹੁਤ ਹੀ ਘੱਟ ਪੈਸੇ ਸੀ ਅਤੇ ਮੈਂ ਸੋਚਿਆ ਕਿ ਘੱਟ ਪੈਸੇ ਨਾਲ ਕਿਵੇਂ ਕੋਈ ਘੁੰਮ ਸਕਦਾ ਹੈ ਪਰ ਮੇਰਾ ਮਨ ਘੁੰਮਣ ਨੂੰ ਇੰਨਾ ਕੀਤਾ ਕਿ ਮੈਂ ਉਸ ਥੋੜ੍ਹੇ ਪੈਸਿਆਂ ਨਾਲ ਹੀ ਮੈਂ ਘੁੰਮਣ ਨਿਕਲ ਗਈ ਮੈਂ ਪੈਸਿਆਂ ਘੱਟ ਦੇ ਨਾਲ ਹੀ ਘੁੰਮਣ ਨਿਕਲ ਗਈ ਉਸ ਵੇਲੇ ਮੈਂ ਅਨੰਦਪੁਰ ਸਾਹਿਬ ਦੀ ਯਾਤਰਾ ਦੇ ਲਈ ਨਿਕਲੀ ਅਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਸਮਝਾਇਆ ਕਿ ਜ਼ਿਆਦੇ ਪੈਸੇ ਖਰਚ ਨਹੀਂ ਕਰਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਸਰਕਾਰੀ ਬੱਸ ਦੀ ਸਹੂਲਤਾਂ ਕੀਤੀ ਹੈ ਅਤੇ ਮੇਰਾ ਕੋਈ ਵੀ ਖਰਚਾ ਨਹੀਂ ਲੱਗਿਆ ਅਨੰਦਪੁਰ ਸਾਹਿਬ ਜੋ ਕਿ ਪੰਜਾਬ ਜ਼ਿਲ੍ਹੇ ਵਿੱਚ ਹੈ ਅਤੇ ਉਸ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ ਮੈਂ ਵੀ ਆਪਣੇ ਘਰ ਤੋਂ ਅਨੰਦਪੁਰ ਸਾਹਿਬ ਬੱਸ 'ਤੇ ਗਈ ਅਤੇ ਮੇਰਾ ਕੋਈ ਵੀ ਖਰਚਾ ਨਹੀਂ ਲੱਗਿਆ ਕਿਉਂਕਿ ਸਰਕਾਰੀ ਬੱਸ ਵਿੱਚ ਇਸਤਰੀਆਂ ਲਈ ਫਰੀ ਬੱਸ ਹੈ ਅਤੇ ਉਸ ਵਿੱਚ ਕੋਈ ਵੀ ਪੈਸਾ ਨਹੀਂ ਲੱਗਦਾ ਅਨੰਦਪੁਰ ਸਾਹਿਬ ਜਾ ਕੇ ਮੈਂ ਉੱਥੇ ਬਹੁਤ ਹੀ ਵਧੀਆ ਤਰ੍ਹਾਂ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਉਸ ਤੋਂ ਬਾਅਦ ਮੈਂ ਉਥੋਂ ਦੀਆਂ ਬਹੁਤ ਹੀ ਜਿਆਦੀਆਂ ਜ਼ਿਆਦਾ ਮਨ ਪਸੰਦ ਚੀਜ਼ਾਂ ਖਰੀਦੀਆਂ ਜਿਵੇਂ ਕਿ ਉੱਥੋਂ ਦੇ ਕੜੇ ਬਹੁਤ ਹੀ ਮਸ਼ਹੂਰ ਹਨ ਉੱਥੋਂ ਦੇ ਕੜੇ ਖਰੀਦਣ ਤੋਂ ਬਾਅਦ ਮੈਂ ਆਪਣੇ ਘਰਦਿਆਂ ਲਈ ਵੀ ਦੋ ਤਿੰਨ ਚੀਜ਼ਾਂ ਖਰੀਦੀਆਂ ਜਿਹੜੀਆਂ ਕਿ ਉਹਨਾਂ ਨੇ ਮੈਨੂੰ ਲਿਆਉਣ ਲਈ ਆਖੀਆਂ ਸਨ ਅਨੰਦਪੁਰ ਸਾਹਿਬ ਵਿੱਚ ਇੰਨੇ ਕੁ ਜ਼ਿਆਦਾ ਲੰਗਰ ਸੀ ਕਿ ਉੱਥੇ ਖਾਣ ਪੀਣ ਲਈ ਵੀ ਆਪਣੇ ਕੋਲੋਂ ਪੈਸੇ ਕੱਢ ਕੇ ਖਰਚਣ ਦੀ ਲੋੜ ਹੀ ਨਹੀਂ ਸੀ ਪੈਂਦੀ ਅਤੇ ਲੰਗਰ ਤੁਸੀਂ ਜਿੱਦਾਂ ਦੇ ਕਹੋ ਤੁਹਾਨੂੰ ਉੱਦਾਂ ਦੇ ਹੀ ਮਿਲ ਜਾਂਦੇ ਸਨ ਲੰਗਰ ਖਾਣ 'ਚ ਵੀ ਬਹੁਤ ਹੀ ਜ਼ਿਆਦਾ ਸ਼ੁੱਧ ਅਤੇ ਸਵਾਦ ਹੁੰਦੇ ਸਨ ਜਿੱਦਾਂ ਜਿਨ੍ਹਾਂ ਦਾ ਸਾਡੀ ਸਰੀਰ 'ਤੇ ਵੀ ਕੋਈ ਵੀ ਬੁਰਾ ਅਸਲ ਵੀ ਨਹੀਂ ਸੀ ਪੈਂਦਾ ਇਸ ਲਈ ਮੈਂ ਅਨੰਦਪੁਰ ਸਾਹਿਬ ਗਈ ਅਤੇ ਘੱਟ ਖਰਚੇ ਵਿੱਚ ਮੈਂ ਆਪਣੇ ਘਰ ਵਾਪਿਸ ਆਈ ਅਤੇ ਘਰ ਆ ਕੇ ਮੈਂ ਆਪਣੀ ਯਾਤਰਾ ਦੇ ਬਾਰੇ ਸਾਰੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਉਹ ਮੇਰੀ ਯਾਤਰਾ ਦੇ ਬਾਰੇ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਨੇ ਵੀ ਇਹ ਯਾਤਰਾ 'ਤੇ ਜਾਣ ਦੀ ਸਲਾਹ ਬਣਾਈ ਧੰਨਵਾਦ ਜੀ